ਹਾਂ ਮੈਂ ਪੇਂਟਿੰਗ ਦੇ ਨਾਲ ਨਾਲ ਸਕੈਚਿੰਗ ਵੀ ਕਰਦੀ ਹਾਂ ਅਤੇ ਪੈਂਸਿਲ ਨਾਲ ਵੀ ਮੈਂ ਕਈ ਵਾਰੀ ਕਲਰ ਫਿਲ ਕਰ ਲੈਂਦੀ ਹਾਂ ਅਤੇ ਪੈਨਸਿਲ ਦੇ ਨਾਲ ਮੈਨੂੰ ਸ਼ੇਡਿੰਗ ਕਰਨਾ ਬਹੁਤ ਵਧੀਆ ਲੱਗਦਾ ਅਤੇ ਉਸ ਨਾਲ ਪੈਂਟਿੰਗ ਵੀ ਬਹੁਤ ਸੋਹਣੀ ਬਣਦੀ ਹੈ ਅਤੇ ਸਕੈਚਿੰਗ ਸਕੈਚਿੰਗ ਨਾਲ ਵੀ ਕਲਰਫੁਲ ਮਲ ਪੇਂਟਿੰਗ ਬਣ ਜਾਂਦੀ ਹੈ ਕਿਉਂਕਿ ਸਕੈਚ ਦੇ ਕਲਰ ਅਲੱਗ ਅਲੱਗ ਡਿਫਰੈਂਟ ਹੁੰਦੇ ਨੇ ਅਤੇ ਉਹਦੇ ਉਹਦੇ ਨਾਲ ਪੇਂਟਿੰਗ 'ਚ ਇੱਕ ਜਾਨ ਜਿਹੀ ਫੂਕੀ ਜਾਂਦੀ ਹੈ ਅਤੇ ਜਿਹੜਾ ਸਕੈਚਿੰਗ ਕਰਨਾ ਹੁੰਦਾ ਹੈ ਜਿਵੇਂ ਕਿ ਸਕੈੱਚ ਬਣਾਉਂਦੇ ਹਾਂ ਆਪਾਂ ਤਾਂ ਉਹ ਸਕੈਚਿੰਗ ਕਰਨੀ ਹੁੰਦੀ ਆ ਉਦੋਂ ਮੈਂ ਪੈਂਸਿਲ ਦਾ ਯੂਜ ਕਰਦੀ ਹਾਂ ਅਤੇ ਪੇਂਟਿੰਗ ਇਸ ਨਾਲ ਜ਼ਿਆਦਾ ਆਸਾਨ ਹੈ ਵੀ ਮੇਰਾ ਆਈਡੀਆ ਆਹੀ ਆ ਵੀ ਪੈਨਸਲ ਦੇ ਨਾਲ ਪੇਂਟਿੰਗ ਕਰਨਾ ਜ਼ਿਆਦਾ ਮਤਲਬ ਵਧੀਆ ਲੱਗਦਾ ਕਿਉਂਕਿ ਉਹ ਇੱਕ ਸਕੈਚ ਤਿਆਰ ਹੁੰਦਾ ਹੈ ਅਤੇ ਉਸ ਵਿੱਚ ਸੈਟਿੰਗ ਜਦੋਂ ਕਰਦੇ ਹਾਂ ਪੈਂਸਿਲ ਨਾਲ ਉਦੋਂ ਸਕੈਚ ਬਹੁਤ ਵਧੀਆ ਪਰ ਉਹਦੇ ਨਾਲ ਕੀ ਹੁੰਦਾ ਜਿਹੜੀ ਪੇਂਟਿੰਗ ਹੁੰਦੀ ਆ ਸਿਰਫ ਬਲੇਕ ਐਂਡ ਵਾਈਟ ਹੀ ਬਣਦੀ ਹੈ ਅਤੇ ਸਕੈਚਿੰਗ ਜਦੋਂ ਸਕੈਚਿੰਗ ਕਰਦੇ ਹਾਂ ਉਸ ਵਿੱਚ ਕੀ ਆ ਕਲਰਫੁਲ ਹੁੰਦੇ ਨੇ ਜਿਵੇਂ ਸਕੈਚ ਅਤੇ ਉਹਦੇ ਵਿੱਚ ਬਾਰ੍ਹਾਂ ਜਾਂ ਸੱਤ ਰੰਗ ਹੁੰਦੇ ਨੇ ਉਹਦੇ ਨਾਲ ਨਾਲ ਪੇਂਟਿੰਗ ਕਲਰਫੁਲ ਅਤੇ ਜਾਨਦਾਰ ਲੱਗਦੀ ਹੈ ਦੇਖਣ ਵਿੱਚ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਅਤੇ ਇਸ ਲਈ ਮੈਨੂੰ ਜ਼ਿਆਦਾ ਸੌਖਾ ਤਾਂ ਪੈਂਸਿਲ ਨਾਲ ਹੀ ਜ਼ਿਆਦਾ ਵਧੀਆ ਲੱਗਦਾ ਪਰ ਬੇਸਿਸ ਸਕੈਚਿੰਗ ਨਾਲ ਵੀ ਪੇਂਟਿੰਗ ਬਹੁਤ ਜ਼ਿਆਦਾ ਵਧੀਆ ਹੋ ਜਾਂਦੀ ਹੈ